ਸਰਕਾਰੀ ਸਕੀਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਤਾਂ ਇਹਨਾਂ ਚੀਜ਼ਾਂ ਦਾ ਇੰਨਾ ਲਾਭ ਨਹੀਂ ਉਠਾ ਪਾ ਰਿਹਾ ਲੇਕਿਨ ਮੇਰੇ ਕੁਝ ਦੋਸਤ ਨੇ ਜੋ ਐਸ ਸੀ ਐਸ ਟੀ ਕੈਟਾਗਰੀ ਦੇ ਉਹ ਇਹਨਾਂ ਚੀਜ਼ਾਂ ਨਾਲ ਕਾਫੀ ਲਾਭ ਉਠਾ ਸਕਦੇ ਨੇ ਜਿਵੇਂ ਕਿ ਜੋ ਲੋਅ ਇਨਕਮ ਸਟੂਡੈਂਟਸ ਪੜ੍ਹਦੇ ਆ ਇੱਥੇ ਮੇਰੀ ਯੂਨੀਵਰਸਿਟੀ 'ਚ ਇਹਨਾਂ ਦੀ ਪੂਰੀ ਜਿਹੜੀ ਫੀਸ ਹੁੰਦੀ ਹੈ ਗੋਰਮੈਂਟ ਸਪੋਂਸਰ ਕਰਦੀ ਹੈ ਅਤੇ ਇਹ ਕਾਫੀ ਵਧੀਆ ਚੀਜ਼ ਆ ਅਤੇ ਜੋ ਕਿ ਸਕੋਲਰਸ਼ਿਪ ਦੇ ਥਰੂ ਉਹਨਾਂ ਨੂੰ ਦਿੱਤੀ ਜਾਂਦੀ ਆ ਅਤੇ ਬਾਕੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸਕੋਲਰਾਂ ਅਤੇ ਜਦੋਂ ਵੀ ਮੈਂ ਅਪ ਡਾਊਨ ਕਰਦਾ ਆਪਣੀ ਯੂਨੀਵਰਸਿਟੀ ਤੱਕ ਜਿਹੜੀਆਂ ਬਸਿਸ ਵਿੱਚ ਮੈਂ ਟਰੈਵਲ ਕਰਦਾ ਅਤੇ ਉੱਥੇ ਜਿਹੜੀਆਂ ਵੂਮੈਨ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਕਾਫੀ ਫੈਸਿਲਿਟੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇਹਨਾਂ ਚੀਜ਼ਾਂ 'ਤੇ ਅਤੇ ਸਟੂਡੈਂਟ ਸਟੂਡੈਂਟ ਕਾਰਡ ਵੀ ਲੱਗਦੇ ਜਿਹਨਾਂ ਨਾਲ ਤੁਸੀਂ ਫਰੀ ਟਰੈਵਲ ਕਰ ਸਕਦੇ ਹੋ ਅਤੇ ਜੇਕਰ ਗੱਲ ਕੀਤੀ ਜਾਵੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਂ ਕਿਸੇ ਹੋਰ ਯੋਜਨਾ ਬਾਰੇ ਤਾਂ ਮੈਂ ਇਹਨਾਂ ਯੋਜਨਾ ਬਾਰੇ ਇੰਨਾ ਨਹੀਂ ਜਾਣਦਾ ਹੈਗਾ ਜੀ ਅਜੇ ਅਤੇ ਜ਼ਰੂਰ ਮੈਂ ਇਹਦੇ ਬਾਅਦ ਇਸ ਚੀਜ਼ ਬਾਰੇ ਪੜ੍ਹਾਂਗਾ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਇਹ ਚੀਜ਼ ਕੀ ਹੈ ਹਾਂਜੀ ਥੈਂਕ ਯੂ